ਮੈਂ ਜਦੋਂ ਸਕੂਲ ਪੜ੍ਹਦੀ ਹੁੰਦੀ ਸੀ ਤਾਂ ਮੈਂ ਸਕੂਲ ਦੇ ਹਰ ਫੰਕਸ਼ਨ ਦੇ ਵਿੱਚ ਹਿੱਸਾ ਲੈਂਦੀ ਹੁੰਦੀ ਸੀ ਅਤੇ ਡਾਂਸ ਦਾ ਮੈਨੂੰ ਇੰਨਾ ਸ਼ੌਂਕ ਹੁੰਦਾ ਸੀ ਕਿ ਜਦੋਂ ਵੀ ਸਾਡੇ ਸਕੂਲ ਕੋਈ ਵੀ ਫੰਕਸ਼ਨ ਹੁੰਦਾ ਸੀ ਤਾਂ ਮੈਂ ਡਾਂਸ ਤਾਂ ਕਰਦੀ ਹੀ ਕਰਦੀ ਸੀ ਜਦੋਂ ਵੀ ਸਾਡੀਆਂ ਡਾਂਸ ਕਲਾਸਾਂ ਲੱਗਦੀਆਂ ਹੁੰਦੀਆਂ ਸੀ ਅਸੀਂ ਡਾਂਸ ਸਿੱਖਦੇ ਰਹਿਣਾ ਸਿੱਖਦੇ ਰਹਿਣਾ ਅਤੇ ਫਿਰ ਹਰ ਫੰਕਸ਼ਨ 'ਤੇ ਡਾਂਸ ਕਰਨਾ ਹੀ ਕਰਨਾ ਅਤੇ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਸੀ ਡ ਉਹਦੇ ਤੋਂ ਕਈ ਦਿਨ ਪਹਿਲਾਂ ਹੀ ਡਾਂਸ ਦੀ ਤਿਆਰੀ ਸ਼ੁਰੂ ਕਰ ਦਿੰਦੇ ਹੁੰਦੇ ਸੀ ਅਤੇ ਫਿਰ ਜਦੋਂ ਫੰਕਸ਼ਨ ਵਾਲੇ ਦਿਨ ਅਸੀਂ ਤਿਆਰ ਸ਼ਿਆਰ ਹੋ ਕੇ ਅਤੇ ਸਟੇਜ 'ਤੇ ਡਾਂਸ ਕਰਦੇ ਹੁੰਦੇ ਸੀ ਅਤੇ ਉਹ ਸਟੇਜ 'ਤੇ ਉਹ ਡਾਂਸ ਕਰਨ ਨਾਲ ਸਾਡਾ ਜਿਹੜਾ ਵਾ ਬਹੁਤ ਹੀ ਸਾਨੂੰ ਮਤਲਬ ਅੰਦਰੋਂ ਬਹੁਤ ਵਧੀਆ ਫੀਲ ਹੁੰਦਾ ਵਾ ਅਤੇ ਸਾਡੇ ਮਨ ਜਿਹੜਾ ਵਾ ਬੜਾ ਮਤਲਬ ਕਿ ਤਾਕਤਵਰ ਬਣਦਾ ਵਾ ਅਤੇ ਸਾਨੂੰ ਹੋਰ ਬੜੇ ਜ਼ਿਆਦਾ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲਦਾ ਵਾ ਇਸ ਤਰ੍ਹਾਂ ਹੀ ਸਾਡੇ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਇਹ ਸਾਡਾ ਟੈਲੈਂਟ ਵਧਦਾ ਜਾਂਦਾ